ਹੈਲੋ ਐਸ ਪੀ ਯੋਗਾ ਤੋਂ ਬੋਲ ਰਹੇ ਹੋ ਹਾਂਜੀ ਮੇਰੇ ਨਾ ਇੱਕ ਦੋਸਤ ਮਿੱਤਰ ਨੇ ਤੁਹਾਡਾ ਨੰਬਰ ਦੱਸਿਆ ਸੀ ਕਿ ਤੁਸੀਂ ਯੋਗਾ ਸਿਖਾਉਂਦੇ ਹੋ ਬੱਚਿਆਂ ਨੂੰ ਅਤੇ ਕੀ ਚਾਰਜਿਸ ਆ ਤੁਹਾਡੇ ਨਹੀਂ ਨਹੀਂ ਦੋਸਤ ਦੋਸਤ ਮਿੱਤਰ ਤਾਂ ਕੋਈ ਨਹੀਂ ਹੈ ਅੱਛਾ ਦੋਸਤ ਮਿੱਤਰ ਤਾਂ ਕੋਈ ਨਹੀਂ ਹੈ ਆਉਣਾ ਤਾਂ ਬੱਚਿਆਂ ਨੇ ਦੋ ਬੱਚਿਆਂ ਨੇ ਵੀਰ ਅਤੇ ਤੁਹਾਡੇ ਟਾਈਮਿੰਗਸ ਕੀ ਹੈ

ਠੀਕ ਹੈ ਠੀਕ ਹੈ ਅਤੇ ਜੇਕਰ ਥੋੜ੍ਹਾ ਟਾਈਮਿੰਗ ਦਾ ਹੋਏ ਦਿੱਕਤ ਜੇਕਰ ਅੱਧਾ ਘੰਟਾ ਪਹਿਲੇ ਹੋ ਜਾਏ ਤਾਂ ਕੋਈ ਦਿੱਕਤ ਤਾਂ ਨਹੀਂ ਹੈ ਤੁਹਾਨੂੰ ਤੁਸੀਂ ਕਰਵਾ ਸਕਦੇ ਹੋ ਠੀਕ ਆ ਠੀਕ ਆ ਅਤੇ ਬੱਚਿਆਂ ਨੂੰ ਸਾਰਾ ਕਰਵਾ ਦਿਓਗੇ ਨਾ ਤੁਸੀਂ ਮਤਲਬ ਠੀਕ ਕਰਵਾਉਂਦੇ ਹੋ ਨਾ ਮੈਨੂੰ ਠੀਕ ਹੈ ਠੀਕ ਅਤੇ ਮੈਂ ਅੱਜ ਬੱਚਿਆਂ ਨੂੰ ਲੈ ਆਵਾਂਗਾ ਤੁਹਾਡਾ ਸ਼ੁਕਰੀਆ